ਹੈਲੋ ਮੀਸ਼ੋ ਕਸਟਮਰ ਕੇਅਰ ਤੋਂ ਗੱਲ ਕਰ ਰਹੇ ਹਾਂਜੀ ਮੈਂ ਦਸ ਦਿਨ ਪਹਿਲੇ ਔਡਰ ਮੰਗਵਾਇਆ ਸੀ ਆਪਣੇ ਅੰਮ੍ਰਿਤਸਰ ਇੱਥੇ ਦਸ਼ਮੇਸ਼ ਅਮੈਨਿਊ ਮੇਰੀ ਔਡਰ ਆਈ ਡੀ ਸਿਕਸ ਵੰਨ ਟੂ ਫਾਈਵ ਫੋਰ ਨਾਈਨ ਹਾਂਜੀ ਹਾਂਜੀ ਅਤੇ ਮੈਂ ਸ਼ੂਜ਼ ਮੰਗਵਾਏ ਸੀ ਜੀ ਪੂਮਾ ਦੇ ਤਿੰਨ ਹਜ਼ਾਰ ਦੇ ਦਸ ਦਿਨ ਪਹਿਲਾਂ ਮੰਗਵਾਏ ਸੀ ਮੇਰੀ ਡਿਲੀਵਰੀ ਇੱਕ ਅੱਜ ਹੋ ਰਹੀ ਹੈ ਇੰਨੀ ਲੇਟ ਤੁਸੀਂ ਡਿਲੀਵਰੀ ਕੀਤੀ ਹੈ ਉੱਤੋਂ ਦੀ ਜਦੋਂ ਮੈਂ ਪੈਕਜ ਖੋਲ੍ਹਿਆ ਅਤੇ ਨ ਉਹਦੇ ਵਿੱਚੋਂ ਨ ਸਾਈਜ਼ ਛੋਟਾ ਨਿਕਲਿਆ ਅਤੇ ਜਿਹੜੀ ਚੀਜ਼ ਤੁਸੀਂ ਦਿਖਾਈ ਹੈ ਮੈਨੂੰ ਉਹ ਤਾਂ ਤੁਸੀਂ ਭੇਜੀ ਨਹੀਂ ਐਨੇ ਖਰਾਬ ਸ਼ੂਜ਼ ਨਿਕਲੇ ਮੇਰੇ ਤਿੰਨ ਹਜ਼ਾਰ ਦੇ ਤੁਸੀਂ ਪੈਸੇ ਲਏ ਮੇਰੇ ਤੋਂ ਬ੍ਰੈਂਡਿਡ ਦੇ ਤੁਸੀਂ ਭੇਜ ਕੁਝ ਹੋਰ ਰਹੇ ਹੋ ਪੰਜ ਸੌ ਵਾਲੇ ਬੂਟ ਭੇਜ ਰਹੇ ਹੋ ਐਨਾ ਖਰਾਬ ਕਟ ਕਸਟਮਰ ਐਕਸਪੀਰੀਅੰਸ ਹੋ ਰਿਹਾ ਮੈਨੂੰ ਮੈਂ ਜੀ ਫਲਿੱਪਕਾਰਟ ਤੋਂ ਮੰਗਵਾਏ ਸੀਗੇ ਅਤੇ ਮੇਰੇ ਕੋਲ ਜੋ ਪਿਛਲੇ ਸਾਲ ਮੈਂ ਫਲਿੱਪਕਾਰਟ ਤੋਂ ਮੰਗਵਾਏ ਸੀ ਮੇਰੇ ਐਨੇ ਵਧੀਆ ਸ਼ੂਜ ਆਏ ਉਹ ਨਾ ਮੈਨੂੰ ਲੋੜ ਪਈ ਦੁਬਾਰਾ ਕਸਟਮਰ ਕੇਅਰ ਨਾਲ ਗੱਲ ਕਰਨ ਦੀ ਉਹਨਾਂ ਨਹੀਂ ਉਹ ਨਾਲ ਟਾਈਮ 'ਤੇ ਡਿਲੀਵਰੀ ਕਰਦੇ ਆ ਨਾਲੇ ਜਿਹੜੀ ਚੀਜ਼ ਦਿਖਾਉਂਦੇ ਉਹੀ ਚੀਜ਼ ਭੇਜਦੇ ਹੈ ਐਦਾਂ ਤਾਂ ਤੁਹਾਡੇ ਤੋਂ ਕੋਈ ਚੀਜ਼ ਬੰਦਾ ਲਏਗਾ ਹੀ ਨਹੀਂ ਕਸਟਮਰ ਦਾ ਐਕਸਪੀਰੀਅੰਸ ਐਨਾ ਖਰਾਬ ਕਰਵਾ ਰਹੇ ਤੁਸੀਂ ਹਾਂਜੀ ਮੈਨੂੰ ਰਿਫੰਡ ਚਾਹੀਦਾ ਜੀ ਤੁਸੀਂ ਸ਼ੂਜ਼ ਵਾਪਸ ਲੈ ਕੇ ਜਾਉ ਅਤੇ ਮੈਨੂੰ ਆਪਣਾ ਰਿਫੰਡ ਚਾਹੀਦਾ ਮੇਰਾ ਰਿਫੰਡ ਦੇ ਨਾਲ ਮੈਂ ਤੁਹਾਡੀ ਰੇਟਿੰਗ ਨੈਗੇਟਿਵ ਪਾਊਂਗਾ ਹੁਣ ਤੁਸੀਂ ਇੰਨਾ ਵੇਟ ਕਰਵਾ ਰਹੇ ਹੋ ਕਸਟਮਰ ਨੂੰ ਉਸ ਤੋਂ ਬਾਅਦ ਤੁਸੀਂ ਚੀਜ਼ ਵੀ ਸਹੀ ਨਹੀਂ ਦੇ ਰਹੇ ਹੋ ਹਾਂਜੀ ਬਿਲਕੁਲ ਯੂ ਸੁਡ ਬੀ ਹਾਂਜੀ ਥੈਂਕ ਯੂ ਜ਼ਰੂਰ ਲੈ ਜਿਓ ਹੁਣ ਵਾਪਸ ਸੂਜ਼ ਅਤੇ ਮੇਰਾ ਰਿਫੰਡ ਟਾਇਮ ਸਿਰ ਪਾ ਦਿਉ ਹਾਂਜੀ ਥੈਂਕ ਯੂ